ਮੈਂ ਇੱਕ ਵਧੀਆ ਡਾਕਟਰ ਕਹਿ ਤਾਂ ਨਹੀਂ ਸਕਦਾ ਪਰ ਮੇਰੇ ਅਕੋਡਿੰਗ ਜਦ ਵੀ ਸਾਡੇ ਪਿੰਡ ਵਿੱਚ ਡਾਂਸ ਹੁੰਦਾ ਹੈ ਕਿਉਂਕਿ ਸਾਡੇ ਪਿੰਡ ਵਿੱਚ ਡਾਂਸ ਬਹੁਤ ਮਹੱਤਵਪੂਰਨ ਹੈ ਇਹ ਸਾਂਝੇ ਸਮਿਆਂ ਵਿੱਚ ਖੁਸ਼ੀਆਂ ਨੂੰ ਮਨਾਉਣ ਦਾ ਇੱਕ ਢੰਗ ਹੈ ਮੌਕੇ ਤੇ ਲੋਕ ਇਕੱਠੇ ਹੋ ਕੇ ਗੀਤ ਗਾਉਂਦੇ ਹਨ ਨੱਚਦੇ ਹਨ ਅਤੇ ਸੰਸਕ੍ਰਿਤੀ ਪਿਰਾਵਾਂ ਨੂੰ ਜੀਵੰਤ ਰੱਖਦੇ ਹਨ ਇਸ ਨਾਲ ਸਤੀਆਂ ਵਿੱਚ ਭਾਈਚਾਰੇ ਦਾ ਭਾਵ ਬੰਦ ਹੈ ਮੈਂ ਇੱਕ ਵਧੀਆ ਡਾਂਸਰ ਤਾਂ ਨਹੀਂ ਪਰ ਭੰਗੜੇ ਦੇ ਕੁਛ ਸਟੈਪ ਬਹੁਤ ਹੀ ਵਧੀਆ ਤਰੀਕੇ ਕਰ ਲੈਂਦਾ ਕਿਉਂਕਿ ਪੰਜਾਬ ਵਿੱਚ ਭੰਗੜਾ ਆਮ ਹ ਤੇ ਹਰ ਇੱਕ ਘਰ ਵਿੱਚ ਭੰਗੜਾ ਪਾਇਆ ਜਾਂਦਾ ਤੇ ਪੰਜਾਬ ਦੇ ਹਰ ਘਰ ਵਿੱਚ ਲੋਕਾਂ ਨੂੰ ਭੰਗੜਾ ਆਉਦਾ ਤੇ ਲੋਕ ਭੰਗੜੇ ਵਿੱਚ ਵਧੀਆ ਖੁਸ਼ੀ ਨਾਲ ਆਪਣਾ ਮਨੋਰੰਜਨ ਕਰਦੇ ਆ ਇਹ ਵੱਖ ਵੱਖ ਮੌਕੇ ਜਿਵੇਂ ਕਿ ਤਿਹਾਰ ਆ ਵਿਆਹਾਂ ਅਤੇ ਸਮਾਜੀ ਸਮਾਜਾਂ ਵਿੱਚ ਕੀਤਾ ਜਾਂਦਾ ਲੋਕ ਡਾਂਸ ਨਾ ਆਪਣੇ ਵਿਆਕਤ ਕਰਦਿਆਂ ਤੇ ਮੌਕੇ ਦੀ ਖੁਸ਼ੀ ਨੂੰ ਸਾਂਝਾ ਕਰ ਦਿਆਂਗੇ ਡਾਂਸ ਦੇ ਰੂਪ ਜਿਵੇਂ ਕਿ ਨੱਚ ਭੰਗੜਾ ਗਿੱਧਾ ਹੋਰ ਰਿਵਾਇਤੀ ਨਿਤ ਸ਼ਾਮਿਲ ਹਨ ਜੋ ਹਰ ਪਿੰਡ ਦੇ ਆਪਣੇ ਵਿਸ਼ੇਸ਼ ਰੰਗ ਨੂੰ ਦਿਖਾਉਂਦੇ ਹਨ ਤੇ ਇਹ ਸਿੱਖਿਆ ਸੰਸਕ੍ਰਿਤੀ ਦੇ ਪੀੜੀਆਂ ਦੇ ਅਧਿਕਤਾ ਸੰਪਰਕ ਬਣਦਾ ਤੇ ਮੈਂ ਇੱਕ ਵਧੀਆ ਡਾਂਸਰ ਬਿਲਕੁਲ ਹਾਂ ਕਿਉਂਕਿ ਮੈਂ ਆਪਣੇ ਭੰਗੜੇ ਦੇ ਸਟੈਪ ਬਿਲਕੁਲ ਵਧੀਆ ਤਰੀਕੇ ਪਾ ਸਕਦਾ ਤੇ ਮੈਂ ਕਹਿ ਸਕਦਾ ਕਿ ਮੈਨੂੰ ਇਕ ਵਧੀਆ ਡਾਂਸਰ ਹੈ ਕਿਉਂਕਿ ਪੰਜਾਬ 'ਚ ਹਰ ਇੱਕ ਪ੍ਰੋਗਰਾਮ ਤੇ ਭੰਗੜਾ ਤੇ ਗਿੱਦਾ ਵਗੈਰਾ ਪਾਇਆ ਜਾਂਦਾ ਗਿੱਧਾ ਅਕਸਰ ਕਿਸੇ ਲੜਕੇ ਦੁਆਰਾ ਨਹੀਂ ਪਾਇਆ ਜਾਂਦਾ ਕਿਉਂਕਿ ਲੜ ਲੜਕਿਆਂ ਨੂੰ ਇਕ ਭੰਗੜਾ ਹੀ ਆਉਂਦਾ ਹੈ ਤੇ ਉਹ ਭੰਗੜਾ ਵਧੀਆ ਤਰੀਕੇ ਦੇ ਇਸ ਲਈ ਸਾਡੇ ਪੰਜਾਬ 'ਚ ਕਿਸੇ ਖੁਸ਼ੀ ਵਿਸਾਖੀ ਤਿਹਾਰ ਜਾਂ ਦਿਵਾਲੀ ਆਦਿ ਤੇ ਜਿਆਦੀ ਭੰਗੜਾ ਪਾਇਆ ਜਾਂਦਾ ਮੈਂ ਇੱਕ ਵਧੀਆ ਤਰੀਕੇ ਡਾਂਸ ਕਰ ਲੈ ਤੇ ਮੇਰੇ ਪਿੰਡ ਦੇ ਲੋਕ ਵੀ ਕਹਿੰਦੇ ਤੂੰ ਵਧੀਆ ਤਰੀਕੇ ਭੰਗੜਾ ਪਾਉਂਦਾ ਹੈ ਜਿਸ ਕਰਕੇ ਮੈਨੂੰ ਵੀ ਲੱਗਦਾ ਕਿ ਮੈਂ ਇੱਕ ਵਧੀਆ ਭੰਗੜੇ ਦਾ ਨ੍ਰਿੱਤ ਪੇਸ਼ ਕਰਨਾ ਤੇ ਇੱਕ ਵਧੀਆ ਡਾਂਸਰ ਹਾਂ ਤੇ ਡਾਂਸਰ ਹੋਣਾ ਕੋਈ ਵੱਡੀ ਗੱਲਬਾਤ ਨਹੀਂ ਹੈ ਕਿਉਂਕਿ ਇਹ ਇੱਕ ਸਟੈਪ ਹੈ ਜੋ ਕਿਸੇ ਵੀ ਦੁਆਰਾ ਸਿੱਖੇ ਜਾ ਸਕਦੇ ਹਨ ਤੇ ਪ੍ਰੋਪਰ ਮਾਤਰਾ ਵਿੱਚ ਟਾਈਮਿੰਗ ਤੇ ਪਵੰਦਿਕ ਤੇ ਗਤੀਵਿਧੀਆਂ ਕਰਦੇ ਤਾਂ ਜੋ ਇੱਕ ਵਧੀਆ ਡਾਂਸਰ ਬਣਿਆ ਜਾ ਸਕੇ ਤੇ ਮੈਂ ਆਪਣੇ ਗੁਰੂ ਤੋਂ ਇਹ ਸਾਰਾ ਕੁਝ ਸਿੱਖਿਆ ਜੋ ਕਿ ਬਹੁਤ ਵਧੀਆ ਕਿ ਡਾਂਸ ਕਰਦੇ ਹਨ ਮੈਨੂੰ ਬਹੁਤ ਹੀ ਵਧੀਆ ਸੁਣਾਇਆ ਭੰਗੜਾ ਪਾਉਣਾ